ਤੁਸੀਂ ਐਮਾਜੋਨ ਤੋਂ ਗੱਲ ਕਰ ਰਹੇ ਹੋ ਮੈਂ ਔਡਰ ਕੀਤਾ ਸੀ ਮੇਰੇ ਪ੍ਰੋਡਕਟ ਦਾ ਨੇਮ ਨੰਬਰ ਪੰਜ ਜੀਰੋ ਛੇ ਪੰਜ ਚਾਰ ਤਿੰਨ ਦੋ ਹੈ ਜੋ ਕਿ ਬਹੁਤ ਹੀ ਖਰਾਬ ਨਿਕਲਿਆ ਇਸ ਕਰਕੇ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਮੈਂ ਉਹ ਡਰੈੱਸ ਫੰਕਸ਼ਨ 'ਤੇ ਪਾਉਣੀ ਸੀ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਮੈਂ ਸਾਰਿਆਂ ਤੋਂ ਵੱਖਰੀ ਲੱਗਾਂਗੀ ਜਦੋਂ ਉਹ ਔਡਰ ਹੋ ਕੇ ਮੇਰੇ ਘਰ ਆਇਆ ਤਾਂ ਜਦੋਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਬਹੁਤ ਹੀ ਵਧੀਆ ਨਹੀਂ ਸੀ ਅਤੇ ਜਦੋਂ ਮੈਂ ਇਸ ਨੂੰ ਸਟਿੱਚ ਕੀਤਾ ਤਾਂ ਉਸ ਦਾ ਇੱਕ ਧੋ ਵਿੱਚ ਹੀ ਕਲਰ ਉੱਡ ਗਿਆ ਅਤੇ ਸਾਰੀ ਕਢਾਈ ਵੀ ਖਰਾਬ ਹੋ ਗਈ ਮੈਂਨੂੰ ਬਹੁਤ ਜ਼ਿਆਦਾ ਕੱਪੜਾ ਖਰਾਬ ਨਿਕਲਿਆ ਅਤੇ ਉਹ ਕੱਪੜਾ ਜਲਦੀ ਹੀ ਫੱਟ ਵੀ ਗਿਆ ਸੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਮੈਂ ਜੋ ਪਹਿਲਾਂ ਔਰ ਕੱਪੜੇ ਔਡਰ ਕਰਦੀ ਸੀ ਉਹ ਬਹੁਤ ਹੀ ਵਧੀਆ ਨਿਕਲ ਜਾਂਦੇ ਸੀ ਅਤੇ ਹੁਣ ਆਹ ਵਾਲ਼ਾ ਇਹ ਕੱਪੜਾ ਬਹੁਤ ਹੀ ਖਰਾਬ ਨਿਕਲਿਆ ਹੈ ਇਸ ਕਰਕੇ ਮੈਂ ਮੈਨੂੰ ਬਹੁਤ ਹੀ ਬੈਡ ਫੀਲ ਹੋ ਰਿਹਾ ਹੈ